ਮੈਂ ਆਪਣੇ ਦੋਸਤ ਦੇ ਘਰ ਅੱਜ ਇੱਕ ਉਹਦੀ ਜਨਮ ਦਿਨ ਦੀ ਪਾਰਟੀ 'ਤੇ ਗਿਆ ਅਤੇ ਦੇਖਿਆ ਕਿ ਉਹਨਾਂ ਦੀ ਰਸੋਈ ਦਾ ਰਸੋਈ ਦੀ ਕਿਚਨ ਦਾ ਜਿਹੜਾ ਟੂਟੀ ਵਾਲਾ ਪਾਣੀ ਜਿੱਥੋਂ ਆਉਂਦਾ ਏ ਉਹ ਲੀਕ ਹੋ ਰਿਹਾ ਸੀ ਅਤੇ ਮੈਂ ਉਸਨੂੰ ਕਿਹਾ ਇਹਨੂੰ ਬੁਲਾ ਕੇ ਠੀਕ ਕਰਵਾ ਲੈ ਅਤੇ ਉਸ ਨੂੰ ਮੈਂ ਇੱਕ ਪਲੰਬਰ ਦਾ ਨੰਬਰ ਦਿੱਤਾ ਕਿ ਇਸ ਨੂੰ ਬਟਾਲਾ ਦੇ ਸਭ ਤੋਂ ਵਧੀਆ ਕੰਮ ਕਰਦਾ ਹੈ ਅਤੇ ਇਸ ਪਾਣੀ ਦੀ ਬਰਬਾਦੀ ਹੈ ਬਹੁਤ ਹੀ ਨੁਕਸਾਨਦਾਇਕ ਹੈ ਇਸ ਲਈ ਉਹਨੂੰ ਕਿਹਾ ਇਸ ਨੂੰ ਠੀਕ ਕਰਵਾ ਅਤੇ ਪਾਣੀ ਇਸਦਾ ਵੱਗਦਾ ਪਾਣੀ ਬੰਦ ਹੋ ਜਾਵੇ ਤਾਂ ਜੋ ਕਿ ਆਸਾਨੀ ਨਾਲ ਕੰਮ ਕੀਤਾ ਜਾ ਸਕੇ ਰਸੋਈ ਦੇ ਵਿੱਚ